ਜਿਹੜਾ ਨੱਚਣਾ ਟੱਪਣਾ ਆ ਉਹ ਤਾਂ ਪੰਜਾਬੀਆਂ ਦੀ ਜਾਨ ਹੈ ਮਤਲਬ ਕੋਈ ਵੀ ਖੁਸ਼ੀ ਦਾ ਮੌਕਾ ਆ ਤਾਂ ਜਾਵੇ ਪੰਜਾਬੀਆਂ ਦੇ ਦਿਮਾਗ 'ਚ ਜਿਹੜੀ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਉਹ ਇਹੀ ਹੁੰਦੀ ਹੈ ਕਿ ਢੋਲ 'ਤੇ ਭੰਗੜਾ ਜਿਹੜੇ ਪੰਜਾਬੀ ਆ ਹਰ ਇੱਕ ਕੋਈ ਵੀ ਤਿਉਹਾਰ ਹੋਵੇ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਉਹ ਨੱਚ ਟੱਪ ਕੇ ਹੀ ਮਨਾਉਂਦੇ ਹਨ ਅਤੇ ਜੇਕਰ ਅਸੀਂ ਪਹਿਰਾਵੇ ਦੀ ਗੱਲ ਕਰੀਏ ਤਾਂ ਨੱਚਣ ਵੇਲੇ ਜਿਹੜੀਆਂ ਕੁੜੀਆਂ ਨੇ ਉਹ ਜ਼ਿਆਦਾਤਰ ਪੰਜਾਬ ਦੇ ਵਿੱਚ ਗਿੱਧਾ ਪ੍ਰੈਫਰ ਕਰਦੀਆਂ ਨੇ ਅਤੇ ਜਿਹੜੇ ਮੁੰਡੇ ਨੇ ਉਹ ਭੰਗੜਾ ਪ੍ਰੈਫਰ ਕਰਦੇ ਨੇ ਅਤੇ ਜਿਹੜੀਆਂ ਇਹਨਾਂ ਦਾ ਪਹਿਰਾਵਾ ਹੁੰਦਾ ਉਹ ਵੀ ਇਸਦੇ ਹ ਮੁਤਾਬਕ ਹੀ ਹੁੰਦਾ ਹੈ ਜਿਵੇਂ ਕਿ ਕੁੜੀਆਂ ਨੇ ਉਹ ਜਾਂ ਤਾਂ ਘੱਗਰਾ ਜਾਂ ਸਲਵਾਰ ਸੂਟ ਜਿਹੜੇ ਪਾਉਣਾ ਜ਼ਿਆਦਾ ਪਸੰਦ ਕਰਦੀਆਂ ਹਨ ਅਤੇ ਸਿਰ ਦੇ ਉੱਤੇ ਚੁੰਨੀਆਂ ਲੈ ਕੇ ਨਾਲ਼ ਸੱਗੀ ਫੁੱਲ ਟਿੱਕਾ ਅਤੇ ਪੈਰਾਂ ਦੇ ਵਿੱਚ ਝਾਂਜਰਾਂ ਚੂੜੀਆਂ ਨੱਥ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਜ਼ਿਆਦਾ ਪ੍ਰੈਫਰ ਕਰਦੀਆਂ ਨੇ ਅਤੇ ਜੇ ਅਗਰ ਅਸੀਂ ਮੁੰਡਿਆਂ ਦੀ ਗੱਲ ਕਰੀਏ ਤਾਂ ਸਿਰ 'ਤੇ ਦਸਤਾਰਾਂ ਅਤੇ ਕੁੜਤਾ ਪਜਾਮਾ ਕੁੜਤਾ ਚਾਦਰਾ ਗਲ਼ 'ਚ ਕੈਂਠੇ ਹੱਥਾਂ ਦੇ ਵਿੱਚ ਡਾਂਗਾਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਮੁੰਡਿਆਂ ਨੂੰ ਬਹੁਤ ਭਾਉਂਦੀਆਂ ਨੇ ਅਤੇ ਇਹ ਜਿਹੜਾ ਉਹਨਾਂ ਦਾ ਪਹਿਰਾਵਾ ਹੈ ਉਹ ਹਮੇਸ਼ਾ ਉਹ ਰੱਖਦੇ ਨੇ ਜਦੋਂ ਵੀ ਗੱਲ ਉਹਨਾਂ ਦੇ ਨਾਚ ਦੀ ਆਵੇ ਜਾਂ ਫਿਰ ਭੰਗੜੇ ਦੀ ਗੱਲ ਆਵੇ ਤਾਂ ਮੁੰਡਿਆਂ ਨੂੰ ਇਹ ਸਭ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਨੇ